ਹੈਲੋ ਹੈਲੋ ਅਰਸ਼ ਬੋਲ ਰਹੀ ਹੈ ਵਧੀਆ ਤੂੰ ਦੱਸ ਹਾਂ ਹਾਂ ਸਭ ਠੀਕ ਅਤੇ ਬੋਲ ਬੋਲ ਮੈਂ ਹਾਂਫ ਤੋਂ ਜ਼ਿਆਦਾ ਮੈਂ ਪੜ੍ਹ ਚੁੱਕੀ ਹਾਂ ਬਸ ਥੋੜ੍ਹਾ ਜਿਹਾ ਹੀ ਰਹਿ ਗਿਆ ਹੈ ਕਿਉਂ ਚਾਹੀਦਾ ਸੀਗਾ ਹਾਂ ਠੀਕ ਆ ਮੈਂ ਇੱਕ ਦੋ ਦਿਨ ਤੱਕ ਮੈਂ ਆਉਣਾ ਤੇਰੀ ਵਾਲੀ ਸਾਈਡ ਅਤੇ ਮੈਂ ਫੜਾ ਜਾਵਾਂਗੀ ਉਦੋਂ ਅਤੇ ਹਾਂ ਵਧੀਆ ਆ ਤੂੰ ਕਿਹੜੀ ਬੂਕ ਪੜ੍ਹ ਰਹੀ ਹੈ ਹੁਣ ਹਾਂਜੀ ਹਾਂ ਮੈਂ ਹੁਣ ਪਿੱਛੇ ਜਦੋਂ ਪੜ੍ਹੀ ਸੀਗੀ ਅਤੇ ਉਹ ਵੀ ਲਾਈਫ ਵਧੀਆ ਹੈ ਦੱਸਿਆ ਹੈ ਕਿ ਕਿਵੇਂ ਆਪਾਂ ਨੂੰ ਮਤਲਬ ਆਪਣੇ ਜਿਹੜੇ ਡਰੀਮਸ ਹੈ ਉਹਦੇ ਉਹਨੂੰ ਅਚੀਵ ਕਰਨਾ ਚਾਹੀਦਾ ਲਾਈਕ ਉਹਦੇ ਵੱਲ ਸਟੈਪਸ ਵਧਾਉਣੇ ਚਾਹੀਦੇ ਤਾਂ ਹੀ ਆਪਾਂ ਨੂੰ ਉਹ ਮਿਲੇਗਾ ਕਿਉਂਕਿ ਆਪਣੀ ਜਿਹੜੀ ਆਪਣਾ ਜਿਹੜਾ ਡੈਸਨੀ ਆ ਉਹ ਤਾਂ ਲਿਖੀ ਹੋਈ ਹੈ ਅਤੇ ਆਪਾਂ ਨੂੰ ਉਹਦੇ ਵੱਲ ਕੰਮ ਕਰਨਾ ਚਾਹੀਦਾ ਹੈ ਮਤਲਬ ਕੋਈ ਬਹਾਨੇ ਬਹੁਨੇ ਮਾਰ ਕੇ ਹੱਥ 'ਤੇ ਹੱਥ ਧਰ ਨਹੀਂ ਬੈਠਣਾ ਚਾਹੀਦਾ ਇੱਕ ਮੈਂ ਪਿੱਛੇ ਜਿਹੇ ਪੜ੍ਹੀ ਸੀਗੀ ਆਈ ਡੋਟ ਲਵ ਯੂ ਐਨੀਮੋਰ ਵਾਲੀ ਉਹ 'ਚ ਲਿਖਿਆ ਹੋਇਆ ਕਿ ਆਪਦੇ ਆਪਦੇ ਆਪ ਨੂੰ ਪਿਆਰ ਕਰਨਾ ਦੱਸਿਆ ਹੋਇਆ ਸਿਖਾਇਆ ਗਿਆ ਹੈ ਕਿ ਲਾਈਕ ਸਾਹਮਣੇ ਵਾਲੇ ਨੂੰ ਐਨੀ ਜ਼ਿਆਦਾ ਇਮਪੋਰਟੈਂਸ ਨਾ ਦਿਉ ਵੀ ਉਹ ਤੁਹਾਨੂੰ ਹਰਟ ਕਰਕੇ ਚਲੇ ਜਾਏ ਅਤੇ ਆਪਦੇ ਆਪ ਨੂੰ ਹੀਲ ਕਿੱਦਾਂ ਕਰਨਾ ਆ ਆਪਦੇ ਮਤਲਬ ਟਰੋਮਾ ਕਹਿ ਲਉ ਜਾਂ ਆਪਣੇ ਜਿਹੜੇ ਜਿਹੜੇ ਲੋਕ ਆਪਾਂ ਨੂੰ ਹਰਟ ਕਰ ਜਾਂਦੇ ਆ ਆਪਾਂ ਨਾਲ ਜ਼ਿਆਦਾ ਕਰ ਜਾਂਦੇ ਆ ਉਹ ਆਪਾਂ ਨੂੰ ਫੋਰ ਗਰਾਂਟਡ ਲੈ ਲੈਂਦੇ ਆ ਅਤੇ ਉਹਨਾਂ ਨੂੰ ਆਪਾਂ ਨੂੰ ਛੱਡ ਦੇਣਾ ਚਾਹੀਦਾ ਹੈ ਹੋਰ

ਹਾਂ ਜਦੋਂ ਮਤਲਬ ਮੈਂ ਦੇਣ ਆਊਗੀ ਆਹ ਤੈਨੂੰ ਬੁੱਕ ਤੂੰ ਉਦੋਂ ਦੇ ਦਈ ਜਿਹੜੀਆਂ ਤੂੰ ਪੜ੍ਹ ਲਈਆਂ ਬਾਕੀ ਜਿਹੜੀਆ ਮੈਂ ਪੜ੍ਹ ਲਈਆਂ ਉਹ ਮੈਂ ਤੈਨੂੰ ਦੇ ਦਊਗੀ ਹਾਂ ਹੂੰ ਵੈਸੇ ਬੁੱਕਸ ਪੜ੍ਹਨਾ ਇਨਟਰਸਟਿੰਗ ਬਹੁਤ ਹੁੰਦਾ ਹੈ ਵਧੀਆ ਟਾਈਮ ਪਾਸ ਹੋ ਜਾਂਦਾ ਹੈ ਹੋਰ ਵਧੀਆ ਸਭ ਚਲ ਹਾਂ ਦੱਸਿਆ ਨਾ ਬੜੀਆ ਦੋ ਦੋ ਇਹਦੇ ਪਿੱਛੇ ਮੈਂ ਕੰਪਲੀਟ ਕਰਕੇ ਛੁੱਟੀ ਹਾਂ ਹਾਂ ਲਾਈਬਰੇਰੀ ਵਿੱਚ ਮੈਂ ਦੇਖਿਆ ਸੀ ਉਦੋਂ ਕਾਫੀ ਨੋਵਲ ਸੀਗੇ ਬਹੁਤ ਵਧੀਆ ਵਧੀਆ ਓਥੇ ਦੇ ਨੋਵਲ ਪਏ ਸੀਗੇ